ਅਰੋਬਿਕਸ ਇੱਕ ਪੱਛਮੀ ਸੱਭਿਅਤਾ ਦੀ ਕਾਢ ਹੈ ਜੋ ਕਿ ਬੰਦੇ ਨੂੰ ਮੈਂਟਲੀ ਸਟਰੈੱਸ ਅਤੇ ਫਿਜ਼ੀਕਲੀ ਸਟਰੋਂਗ ਰੱਖਣ ਲਈ ਇੱਕ ਐਕਸਰਸਾਈਜ਼ ਦਾ ਜ਼ਰੀਆ ਬਣਾਇਆ ਹੈ ਅਰੋਬਿਕਸ ਦੇ ਵਿੱਚ ਪੱਛਮੀ ਸਭਿਅਤਾ ਦੇ ਲੋਕ ਮੈਂਟਲੀ ਸਟਰੈੱਸਡ ਅਤੇ ਫਿਜੀਕਲੀ ਸਟਰੋਂਗ ਬਣਦੇ ਨੇ ਇਸ ਹੀ ਤਰ੍ਹਾਂ ਪੰਜਾਬ ਦਾ ਫੋਕ ਡਾਂਸ ਭੰਗੜਾ ਹੈ ਜਿਹਦੇ ਵਿੱਚ ਭੰਗੜਾ ਕਰਦੇ ਹੋਏ ਲੋਕ ਆਪਣੇ ਆਪ ਨੂੰ ਮੈਂਟਲੀ ਸਟਰੈੱਸਡ ਅਤੇ ਫਿਜ਼ੀਕਲੀ ਸਟਰੋਂਗ ਬਣਾਉਂਦੇ ਨੇ ਭੰਗੜਾ ਇੱਕ ਐਸਾ ਪੰਜਾਬ ਦਾ ਫੋਕ ਡਾਂਸ ਹੈ ਜਿਹਦੇ ਵਿੱਚ ਪੰਜਾਬੀ ਫੋਕ ਦੇ ਗਾਣਿਆਂ ਨੂੰ ਲਗਾ ਕੇ ਲੋਕ ਇੰਜੋਏ ਵੀ ਕਰਦੇ ਨੇ ਅਤੇ ਭੰਗੜੇ ਦੇ ਨਾਲ ਲੋਕ ਆਪਣੇ ਆਪ ਨੂੰ ਫਿੱਟ ਵੀ ਰੱਖਦੇ ਨੇ ਭੰਗੜੇ ਦੇ ਵਿੱਚ ਵੀ ਐਸੀ ਕੁਛ ਐਕਸਸਾਈਜ਼ ਐਸੀ ਹੈ ਕਿ ਲੋਕ ਇਹਦੇ ਵਿੱਚ ਆਪਣੇ ਆਪ ਨੂੰ ਤੰਦਰੁਸਤ ਵੀ ਰੱਖ ਸਕਦੇ ਨੇ ਭੰਗੜਾ ਵਿੱਚ ਅਰੋਬਿਕਸ ਵਾਂਗ ਹੀ ਯੂਜ਼ ਕੀਤੀ ਗਈ ਕਿਰਿਆਵਾਂ ਆਉਂਦੀਆਂ ਨੇ ਜੋ ਕਿ ਬੰਦੇ ਨੂੰ ਮੈਂਟਲੀ ਅਤੇ ਸਟਰੈਸ ਫਰੀ ਕਰਦੀਆਂ ਨੇ ਅਤੇ ਫਿਜ਼ੀਕਲੀ ਵੀ ਬੰਦੇ ਨੂੰ ਬਾਡੀ ਵੱਲੋਂ ਵੀ ਸਟਰੋਂਗ ਕਰਦੀਆਂ ਨੇ